ਹਾਂ ਮੈਂ ਆਪਣੇ ਸਕੂਲ ਦੇ ਕਈ ਫੰਕਸ਼ਨਾਂ ਵਿੱਚ ਹਿੱਸਾ ਲਿਆ ਮੈਨੂੰ ਫੰਕਸ਼ਨ ਅਟੈਂਡ ਕਰਨੇ ਬਹੁਤ ਅੱਛੇ ਲੱਗਦੇ ਸੀ ਔਰ ਸਕੂਲ ਦੇ ਫੰਕਸ਼ਨਾਂ ਵਿੱਚ ਮੈਂ ਕਾਫੀ ਮਤਲਬ ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ ਮੈਂ ਡਾਂਸ ਕਰਨਾ ਮੈਨੂੰ ਬਹੁਤ ਪਸੰਦ ਸੀ ਮੈਂ ਬਹੁਤ ਡਾਂਸ ਕਰਿਆ ਆਪਣੇ ਸਕੂਲ ਦੇ ਫੰਕਸ਼ਨਾਂ ਵਿੱਚ ਔਰ ਕਾਫੀ ਅੱਗੇ ਤੱਕ ਜਿਸ ਤਰ੍ਹਾਂ ਪੰਦਰ੍ਹਾਂ ਅਗਸਤ ਛੱਬੀ ਜਨਵਰੀ ਔਰ ਹੋਰ ਵੀ ਕਈ ਐਨੁਅਲ ਫੰਕਸ਼ਨ ਜਿਹਨਾਂ ਦੇ ਵਿੱਚ ਅਸੀਂ ਹਿੱਸਾ ਲੈਂਦੇ ਸੀ ਬਹੁਤ ਅੱਛਾ ਲੱਗਦਾ ਸੀ ਡਾਂਸ ਕਰਨਾ ਔਰ ਫੰਕਸ਼ਨ ਅਟੈਂਡ ਕਰਨੇ ਆਪਣੀ ਫਰੈਂਡਸ ਨਾਲ ਆਪਣੇ ਫੰਕਸ਼ਨਾਂ ਦੇ ਵਿੱਚ ਡਾਂਸ ਵਗੈਰਾ ਔਰ ਫੰਕਸ਼ਨ ਬਹੁਤ ਅੱਛੇ ਤਰ੍ਹਾਂ ਕਰੇ ਜਾਂਦੇ ਸੀ ਸਕੂਲ ਵਿੱਚ ਔਰ ਕਈ ਵਾਰ ਅਸੀਂ ਫੰਕਸ਼ਨਾਂ ਵਾਸਤੇ ਬਾਹਰ ਵੀ ਜਾਂਦੇ ਸੀ ਜਿਸ ਤਰ੍ਹਾਂ ਕਈ ਕਾਲਜ ਵਿੱਚ ਜਾਂ ਕਿਸੀ ਹੋਰ ਜਗ੍ਹਾ ਜਿੱਦਾਂ ਕਿਸੇ ਹੋਰ ਸਕੂਲ ਵਿੱਚ ਫੰਕਸ਼ਨ ਵਾਸਤੇ ਸਾਨੂੰ ਲਿਜਾਇਆ ਜਾਂਦਾ ਸੀ ਔਰ ਬਹੁਤ ਅੱਛੀ ਤਰ੍ਹਾਂ ਅੱਛੇ ਫੰਕਸ਼ਨ ਹੁੰਦੇ ਸੀ ਜਿਸ ਵਿੱਚ ਅਸੀਂ ਡਾਂਸ ਕਰਨਾ ਔਰ ਗੇਮਸ ਖੇਲਣਾ ਔਰ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਸੀ ਜਿਸ ਤਰ੍ਹਾਂ ਬੋਲਣਾ ਜ਼ਿਆਦਾਤਰ